ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਨੌਜਵਾਨਾਂ ਵਿੱਚ ਵੱਧ ਰਹੀ ਬੇਰੁਜ਼ਗਾਰੀ ਬਾਰੇ ਕੁਝ ਵਿਚਾਰ ਆਪ ਜੀ ਨਾਲ ਸਾਂਝਾ ਕਰਾਂਗੀ ਕਹਿੰਦੇ ਨੇ ਕਿ ਬੇਵ ਬੇਰੁਜ਼ਗਾਰ ਵਿਅਕਤੀ ਜਿਹੜਾ ਹੈ ਉਸਨੂੰ ਸਮਾਜ ਨਕਾਰਾ ਸਮਝਦਾ ਹੈ ਰਿਸ਼ਤੇਦਾਰ ਸਾਕ ਸਬੰਧੀ ਆਂਢ ਗੁਆਂਢ ਦੇ ਲੋਕ ਬੇਰੁਜ਼ਗਾਰ ਵਿਅਕਤੀ ਨੂੰ ਵਿਹਲੜ ਅਤੇ ਬੇਕਾਰ ਸਮਝਣ ਲੱਗ ਜਾਂਦੇ ਹਨ ਅਪਮਾਨ ਅਤੇ ਤਿਰਸਕਾਰ ਸ਼ਬਦ ਜਿਹੜੇ ਇਹ ਦੋ ਸ਼ਬਦ ਹਨ ਇਹ ਕਿਸੇ ਰਿਸ਼ਤੇ ਨੂੰ ਜੋੜ ਕੇ ਨਹੀਂ ਬਣਦੇ ਕਿਸੇ ਨਾਲ ਵੀ ਕੋਈ ਜੋੜ ਜਾਂ ਮੇਲ ਨਹੀਂ ਹੁੰਦਾ ਬਲਕਿ ਬੇਰੁਜ਼ਗਾਰ ਵਿਅਕਤੀ ਅਪਮਾਨ ਸਹਿੰਦਾ ਹੈ ਤਿਰਸਕਾਰ ਦਾ ਸ਼ਿਕਾਰ ਹੁੰਦਾ ਹੈ ਰਿਸ਼ਤੇਦਾਰ ਉਸ ਤੋਂ ਕੰਨੀ ਕਤਰਾਉਣ ਲੱਗ ਜਾਂਦੇ ਹਨ ਅੱਜ ਦੇਖਿਆ ਜਾਵੇ ਤਾਂ ਬਹੁਤ ਹੀ ਨੌਜਵਾਨ ਉੱਚੀਆਂ ਡਿਗਰੀਆਂ ਹਾਸਲ ਕਰਨ ਦੇ ਬਾਵਜੂਦ ਵੀ ਬੇਰੁਜ਼ਗਾਰ ਹਨ ਨੌਜਵਾਨ ਡਿਗਰੀਆਂ ਲੈ ਕੇ ਨੌਕਰੀ ਦੀ ਤਲਾਸ਼ ਵਿੱਚ ਖੱਜਲ ਖੁਆਰ ਹੋ ਰਹੇ ਹਨ ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਕਈ ਨੌਜਵਾਨ ਥੱਕ ਹਾਰ ਕੇ ਖੱਜਲ ਖੁਆਰ ਹੋ ਕੇ ਨੌਕਰੀਆਂ ਨਾ ਮਿਲਣ ਤੋਂ ਬਾਅਦ ਮਜ਼ਬੂਰਨ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਰਿਕਸ਼ਾ ਚਲਾਉਣ ਲੱਗ ਪੈਂਦੇ ਹਨ ਕਈ ਸਬਜ਼ੀ ਵੇਚਣ ਰੇੜ੍ਹੀ ਲਗਾਉਣ ਲਈ ਮਜ਼ਬੂਰ ਹੋ ਜਾਂਦੇ ਹਨ ਇੱਥੋਂ ਤੱਕ ਕਈ ਵਾਰੀ ਤਾਂ ਅਜਿਹਾ ਹੁੰਦਾ ਹੈ ਕਈ ਨੌਜਵਾਨ ਤੰਗ ਆ ਕੇ ਆਪਣੀ ਜੀਵਨ ਲੀਲਾ ਹੀ ਖਤਮ ਕਰ ਲੈਂਦੇ ਹਨ ਉਹ ਹੀ ਵਿਅਕਤੀ ਜਿਹੜਾ ਕਿ ਇੱਕ ਮਾਪਿਆਂ ਦਾ ਸਹਾਰਾ ਬਣਨਾ ਹੁੰਦਾ ਹੈ ਮਾਪਿਆਂ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਪੜ੍ਹਾਇਆ ਹੁੰਦਾ ਹੈ ਕਿ ਆਉਣ ਵਾਲੇ ਵਕਤ ਵਿੱਚ ਆਉਣ ਵਾਲੇ ਸਮੇਂ ਵਿੱਚ ਇਹ ਹੀ ਸਾਡਾ ਸਹਾਰਾ ਬਣੇਗਾ ਕੋਈ ਨੌਕਰੀ 'ਤੇ ਲੱਗੇਗਾ ਪਰ ਜਦੋਂ ਉਹ ਵਿਅਕਤੀ ਮਜ਼ਬੂਰ ਹੋ ਕੇ ਲੋਕਾਂ ਦੇ ਤਾਹਨੇ ਮਿਹਣੇ ਸਹਿ ਕੇ ਆਪਣੇ ਆਪ ਨੂੰ ਨਮੋਸ਼ੀ ਦੀ ਹੱਦ ਤੱਕ ਜਾ ਕੇ ਆਪਣਾ ਜੀਵਨ ਲੀਲਾ ਹੀ ਆਪਣੀ ਖਤਮ ਕਰ ਲੈਂਦਾ ਹੈ ਤਾਂ ਉਹ ਮਾਪਿਆਂ ਦਾ ਤਾਂ ਹਾਲਤ ਦੇਖਣ ਵਾਲੀ ਹੀ ਹੁੰਦੀ ਹੈ ਕਹਿੰਦੇ ਨੇ ਨਾ ਕਿ ਪੜ੍ਹੋਗੇ ਲਿਖੋਗੇ ਤਾਂ ਬਣੋਗੇ ਨਵਾਬ ਪਰ ਨਹੀਂ ਅੱਜ ਤਾਂ ਕਹਾਵਤ ਇਹ ਹੋ ਗਈ ਹੈ ਕਿ ਪੜ੍ਹੋਗੇ ਲਿਖੋਗੇ ਬਣੋਗੇ ਬੇਰੁਜ਼ਗਾਰ ਅੱਜ ਦੇਖਿਆ ਜਾਵੇ ਤਾਂ ਹਰ ਮਹਿਕਮੇ ਵਿੱਚ ਨੌਜਵਾਨ ਨੌਕਰੀ ਲਈ ਧਰਨੇ ਲਾ ਰਹੇ ਹਨ ਭੁੱਖ ਹੜਤਾਲ 'ਤੇ ਬੈਠ ਰਹੇ ਹਨ ਪਰ ਸਰਕਾਰ ਦਾ ਇਸ 'ਤੇ ਕੋਈ ਅਸਰ ਨਹੀਂ ਸਰਕਾਰ ਨੂੰ ਕੁਝ ਅਜਿਹੇ ਕਿੱਤੇ ਚੁਣਨੇ ਚਾਹੀਦੇ ਹਨ ਜਿੰਨਾਂ ਵਿੱਚ ਛੋਟੇ ਛੋਟੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਗਲੀ ਮੁਹੱਲਿਆਂ ਵਿੱਚ ਅਜਿਹੇ ਕਿੱਤੇ ਖੋਲਣ ਜਿਵੇਂ ਕਿ ਛੋਟੇ ਲੜਕੀਆਂ ਜਾਂ ਬੇਰੁਜ਼ਗਾਰ ਨੌਜਵਾਨ ਜਿੰਨ੍ਹਾਂ ਨੂੰ ਨਿੱਕੇ ਨਿੱਕੇ ਜਿਹੜੇ ਘੱਟ ਪੜ੍ਹੇ ਹੁੰਦੇ ਹਨ ਉਹਨਾਂ ਨੂੰ ਕੋਈ ਛੋਟੇ ਰੁਜ਼ਗਾਰ ਮਿਲ ਜਾਣ ਅਤੇ ਆਪਣਾ ਜੀਵਨ ਬਸਰ ਕਰ ਸਕਣ ਸਰਕਾਰ ਨੂੰ ਇਹਨਾਂ ਬਾਰੇ ਕੋਈ ਪਹਿਲ ਕਦਮੀ ਕਰਨੀ ਚਾਹੀਦੀ ਹੈ ਸਰਕਾਰ ਨੂੰ ਹਰ ਘਰ ਵਿੱਚ ਇੱਕ ਵਿਅਕਤੀ ਜਿਹੜਾ ਕਿ ਉਹ ਪੜ੍ਹਿਆ ਲਿਖਿਆ ਹੋਵੇ ਉਹਨੂੰ ਜ਼ਰੂਰ ਨੌਕਰੀ ਦੇਣ ਲਈ ਵਾਅਦਾ ਕਰਨਾ ਚਾਹੀਦਾ ਹੈ ਅੱਜ ਦੇਖਿਆ ਜਾਵੇ ਤਾਂ ਉੱਚ ਡਿਗਰੀਆਂ ਲੈ ਕੇ ਬੱਚੇ ਈਵਨ ਕਿ ਆਪਣਾ ਟੈਸਟ ਪਾਸ ਕਰਕੇ ਵੀ ਯੂ ਜੀ ਸੀ ਵਰਗੇ ਟੈਸਟ ਪਾਸ ਕਰਕੇ ਪੀ ਐੱਚ ਡੀ ਦੀਆਂ ਡਿਗਰੀਆਂ ਤੱਕ ਹਾਸਿਲ ਕਰਕੇ ਨੌਕਰੀ ਤੋਂ ਬੇਕਾਰ ਹਨ ਜਾਂ ਕੱਚਿਆਂ ਵਿੱਚ ਜਿੰਨ੍ਹਾਂ ਨੂੰ ਕਿ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾਂਦਾ ਅਜਿਹੇ ਮਹਿਕਮੇ ਹਨ ਕਈ ਤਰ੍ਹਾਂ ਦੇ ਸੋ ਮੇਰੀ ਇਹ ਹੀ ਅਪੀਲ ਹੈ ਕਿ ਸਰਕਾਰ ਇਸ ਬਾਰੇ ਜ਼ਰੂਰ ਧਿਆਨ ਦਵੇ ਧੰਨਵਾਦ